ਅੱਜ ਕੱਲ੍ਹ ਨੌਜਵਾਨਾਂ ਨੂੰ ਸਭ ਤੋਂ ਵੱਡੀ ਜਿਹੜੀ ਰੁਕਾਵਟ ਹੈ ਉਹ ਇਹ ਆ ਰਹੀ ਹੈ ਕਿ ਜੋ ਰੇਲਵੇ ਦੀ ਬੁਕਿੰਗ ਉਹ ਬਹੁਤ ਆਸਾਨੀ ਦੇ ਨਾਲ ਨਹੀਂ ਮਿਲਦੀ ਅਤੇ ਜੇ ਮਿਲਦੀ ਹੈ ਤਾਂ ਉਹਦੀ ਜਿਹੜੀ ਕੀਮਤ ਉਹ ਬਹੁਤ ਵ ਬਹੁਤ ਵੱਧ ਹੁੰਦੀ ਹੈ ਜਿਸ ਨਾਲ ਇੱਕ ਜਿਹੜਾ ਨੌਜਵਾਨਾਂ ਉਸਦਾ ਗੁਜ਼ਾਰਾ ਨਹੀਂ ਹੁੰਦਾ ਕਿ ਉਹ ਰੇਲਵੇ ਦੀ ਬੁੱਕਿੰਗ ਲਈ ਇੰਨੀ ਕੀਮਤ ਦੇਵੇ ਇਸ ਲਈ ਜੋ ਇਹ ਰੁਕਾਵਟ ਹੈ ਜੋ ਕਿ ਸਾਨੂੰ ਯਾਤਰਾ ਕਰਨ ਲਈ ਬਹੁਤ ਪਰੇਸ਼ਾਨ ਕਰਦੀ ਹੈ ਅਤੇ ਇਸ ਨੂੰ ਸਹੀ ਕਰਨ ਲਈ ਮੈਂ ਆਪਣੇ ਦੋਸਤ ਕੋਲ ਗਿਆ ਸੀ ਪਰ ਉਸ ਨੇ ਮੈਨੂੰ ਕੋਈ ਹੱਲ ਨਹੀਂ ਦਿੱਤਾ ਇਸ ਲਈ ਮੈਂ ਚਾਹੁੰਦੀ ਹਾਂ ਕਿ ਮੈਨੂੰ ਤੁਸੀਂ ਇੱਕ ਹੱਲ ਭੇਜੋ ਜਿਸ ਲਈ ਮੈਂ ਆਪਣੇ ਆਪਣੀ ਬੁਕਿੰਗ ਅਤੇ ਆਪਣੀ ਯਾਤਰਾ ਸਫ਼ਲ ਕਰ ਸਕਾਂ ਜਿਸ ਨਾਲ ਮੇਰਾ ਖਰਚਾ ਵੀ ਘੱਟ ਹੋਵੇਗਾ ਅਤੇ ਮੇਰਾ ਟਾਈਮ ਦਾ ਸਮਾਂ ਵੀ ਬਚੇਗਾ ਤਾਂ ਅਤੇ ਮੇਰਾ ਵੀ ਜਿਹੜਾ ਸੁਭਾਅ ਹੈ ਉਹ ਵੀ ਵਧੀਆ ਹੀ ਰਹੇਗਾ ਅਤੇ ਮੈਂ ਤਨ ਤੁਹਾਡੀ ਧੰਨਵਾਦੀ ਹੋਵਾਂਗੀ ਕਿਉਂਕਿ ਜੇ ਤੁਸੀਂ ਮੈਨੂੰ ਇਸ ਇਸ ਪ੍ਰਤੀ ਤੁਸੀਂ ਮੈਨੂੰ ਕੋਈ ਉਹ ਭੇਜੋ